ਪਹਿਲਾਂ ਪੁਰਾਣੇ ਸਿਆਣੇ ਬਲਦਾਂ ਦੀ ਖੇਤੀ ਵੀ ਬਲਦਾਂ ਨਾਲ ਖੇਤੀ ਕਰਨੀ ਅ ਹੁਣ ਅੱਜ ਦੇ ਦਿਨ 'ਚ ਦੇਖੋ ਕਿੱਡੇ ਕਿੱਡੀਆਂ ਬੜੀਆਂ ਮਸ਼ੀਨਾਂ ਕਿੱਡੇ ਕਿੱਡੇ ਬੜੇ ਟਰੈਕਟਰ ਵੀ ਹਾਂ ਇਕੱਲੇ ਇਕੱਲੇ ਘਰ ਦੋ ਦੋ ਤਿੰਨ ਤਿੰਨ ਟਰੈਕਟਰ ਵੀ ਖੜ੍ਹੇ ਹੁੰਦੇ ਨੇ ਅਤੇ ਜਦੋਂ ਪਹਿਲੇ ਸਮੇਂ 'ਚ ਸਿਆਣੇ ਕੰਮ ਕਰਦੇ ਤੇ ਸਰੀਰ ਸਹੀ ਰਹਿੰਦਾ ਤਾ ਅੱਜ ਦੇ ਸਮੇਂ 'ਚ ਕੀ ਹੈ ਟਰੈਕਟਰ ਹੈਗੇ ਤਾਂ ਲੋਕ ਘੰਟਾ ਬੰਦਾ ਵਾਹੁਦਾ ਉਸ ਦਿਨ ਕਿੱਲਾ ਵਾਹੁਣ ਨੂੰ ਅੱਧੀ ਅੱਧੀ ਦਿਹਾੜੀ ਦਿਹਾੜੀ ਦਿਹਾੜੀ ਵੀ ਲੱਗ ਜਾਂਦੀ ਇਸ ਆ ਹੁਣ ਦੇ ਟਾਇਮ ਦੇ ਵਿੱਚ ਜ ਬੰਦਾ ਜਾਂਦਾ ਖੇਤ ਕਿੱਲਾ ਵਾਹੁਣਾ ਪੰਦਰਾਂ ਵੀਹ ਮਿੰਟ ਦਾ ਕੰਮ ਆ ਕੇ ਵਿਹਲਾ ਆ ਕੇ ਬੰਦਾ ਬਸ ਵਿਹਲਾ ਬੈਠਾ ਰਹਿੰਦਾ ਹਾਂ ਬਹੁਤ ਸਾਰੀਆਂ ਮਸ਼ੀਨਰੀਆਂ ਆ ਗਈਆਂ ਰੂਟਾਵੇਟਰ ਫਾਲ਼ੇ ਸੁਹਾਗੇ ਸੁਪਰਸੀਡਰ ਕੱਟਰ ਅੱਗੇ ਬੰਦਾ ਕੱਟਰ ਹੈ ਹੁੰਦਾ ਅੱਗੇ ਬੰਦਾ ਪਰਾਲੀ ਜਿਹੜੀ ਵੱਢ ਹੋ ਗਈ ਥੱਲੇ ਵੱਢ ਕੇ ਝੁੰਡੇ ਪਸ਼ੂਆਂ ਨੂੰ ਪਾਉਣੇ ਹੁਣ ਉਹ ਕਟਰ ਮਾਰਦਾ ਇਕੱਠੀ ਕਰ ਦਿੰਦਾ ਬੰਦਾ ਪਰਾਲੀ ਸੁਪਰਸੀਡਰ ਨਾਲ ਕਣਕ ਬੀਜ ਹੁੰਦੀ ਹੈ ਜਿਹੜੇ ਝੁੰਡੇ ਹੁੰਦੇ ਝੁੰਡਿਆਂ ਦੇ ਵਿੱਚੇ ਹੀ ਖੜ੍ਹੇ ਖੜ੍ਹਿਆਂ ਦੇ ਵਿੱਚ ਉਹ ਕਣਕ ਬੀਜ ਦੇਣੀ ਫਾਲ਼ੇ ਸੁਹਾਗਾ ਰੂਟਾਵੇਟਰ ਬੱਟ ਵਰਬ ਆਲੂ ਬੀਜਣੇ ਵਾਲੀ ਮਸ਼ੀਨ ਆਲੂ ਪੱਟਣੇ ਵਾਲੀ ਮਸ਼ੀਨ ਹੁਣ ਅੱਗੇ ਆਲੂ ਬੰਦਾ ਵੱਟਾਂ ਬਣਾ ਕੇ ਵਿੱਚ ਦੱਬ ਦੇ ਤੇ ਹੁਣ ਆਲੂ ਵਾਲੀ ਮਸ਼ੀਨ ਆ ਗਈ ਉਹਦੇ ਨਾਲ ਸਾਨੂੰ ਆਲੂ ਵਿੱਚ ਪਿੱਛੇ ਚਾਰ ਬਈਏ ਬਹਿੰਦੇ ਚਾਰ ਬਈਏ ਆਲੂ ਵਿੱਚ ਪਾਈ ਜਾਂਦੇ ਮਸ਼ੀਨ ਨੇ ਵੱਟਾਂ ਬਣਾ ਕੇ ਆਲੂ ਵਿੱਚ ਪਈ ਜਾਂਦੇ ਹੈ ਅੱਜ ਦੇ ਟਾਈਮ 'ਚ ਇਹ ਚੱਲ ਰਿਹਾ ਪਿਛਲੇ 'ਚ ਠੀਕ ਸੀਗਾ ਸਿਆਣੇ ਜਦੋਂ ਕੰਮ ਕਰਦੇ ਤੇ ਬਹੁਤ ਵਧੀਆ ਤੇ ਕੰਮ ਕਰਦੇ ਸਰੀਰ ਸਿਆਣਿਆਂ ਦਾ ਸੈੱਟ ਵੀ ਰਹਿੰਦਾ ਤਾ ਅੱਜ ਦੇ ਟਰੈਟਰ ਟਰੈਕਟਰ ਇਕੱਲੇ ਇਕੱਲੇ ਘਰ ਤਿੰਨ ਤਿੰਨ ਚਾਰ ਚਾਰ ਟਰੈਕਟਰ ਖੜ੍ਹੇ ਅਤੇ ਫ਼ਸਲ ਵੱਢਣੀ ਸਿੱਧੀ ਮੰਡੀ ਅੱਗੇ ਥੈਲਿਆਂ 'ਚ ਦਾਣੇ ਪੈਂਦੇ ਤੇ ਹੁਣ ਟਰੈਲੀਆਂ 'ਚ ਪੈਂਦੇ ਹੈ ਅਤੇ ਲੋਕ ਰੇ ਅੱਗੇ ਰੇੜ੍ਹਿਆ ਪਰ ਲੈ ਕੇ ਜਾਂਦੇ ਤੇ ਹੁਣ ਟਰਾਲੀਆਂ ਆ ਗਈਆਂ ਟਰਾਲੀਆਂ ਸਿੱਧਾ ਮੰਡੀ ਜਾਂਦੇ ਮੰਡੀ ਜੈੱਕ ਹੋ ਗਏ ਅੱਗੇ ਸਿਆਣੇ ਹੱਥਾਂ ਨਾਲ ਖਾਲੀ ਕਰਦੇ ਹੁਣ ਨਵੀਂ ਟਕਨੀਕ ਆ ਗਈ ਵੀ ਜੈੱਕ ਚੱਕਣੇ ਜੈੱਕਾਂ ਨਾਲ ਟਰਾਲੀਆਂ ਖਾਲੀ ਕਰਨੀਆਂ ਬੰਦਾ ਜਾਂਦਾ ਦਸ ਮਿੰਟ ਲਾਉਂਦਾ ਟਰਾਲੀ ਵਿਚਾਰੇ ਪਹਿਲਾਂ ਸਿਆਣੇ ਖੁਰਾਕ ਵੀ ਹੁੰਦੀ ਤੀ ਖੁਰਾਕ ਵੀ ਖਾਂਦੇ ਤੇ ਕੰਮ ਵੀ ਕਰਦੇ ਤੇ ਇਹਦੇ ਨਾਲ ਬਹੁਤ ਜ਼ਿਆਦਾ ਬੈਨੀਫਿਟ ਤੇ